ਵੀਹ ਸਤੰਬਰ ਦੋ ਹਜ਼ਾਰ ਚਾਰ ਦੋ ਦਸੰਬਰ ਦੋ ਹਜ਼ਾਰ ਇੱਕ ਇੱਕ ਦਸੰਬਰ ਦੋ ਹਜ਼ਾਰ ਪੰਜ ਗਿਆਰ੍ਹਾਂ ਨਵੰਬਰ ਉੱਨੀ ਸੌ ਨੜਿਨਵੇਂ ਫਰਵਰੀ ਵੀਹ ਦੋ ਹਜ਼ਾਰ ਸੱਤ